ਅਸੀਂ ਪੰਜਾਬ ਜ਼ਿਲ੍ਹੇ ਦੇ ਨਿਵਾਸੀ ਹਾਂ ਅਤੇ ਸਾਡੇ ਖੇਤਰ 'ਚ ਜ਼ਿਆਦਾਤਰ ਤਾਂ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣਾਈ ਜਾਂਦੀ ਹੈ ਇਸ ਤੋਂ ਇਲਾਵਾ ਕੜਾਹੀ ਪਨੀਰ ਹੋ ਗਿਆ ਸ਼ਾਹੀ ਪਨੀਰ ਹੋ ਗਿਆ ਅਤੇ ਛੋਲੇ ਭਟੂਰੇ ਹੋ ਗਏ ਦਾਲ ਮੱਖਣੀ ਆਲੂ ਦਾ ਪਰੌਂਠਾ ਇਹ ਸਾਡੇ ਰਵਾਇਤੀ ਪਕਵਾਨ ਨੇ ਜਦੋਂ ਵੀ ਕੋਈ ਮਹਿਮਾਨ ਆਉਂਦਾ ਤਾਂ ਸਾਡੇ ਘਰ ਆਹ ਸਾਰੇ ਪਕਵਾਨ ਬੜੇ ਹੀ ਖੁਸ਼ੀ ਖੁਸ਼ੀ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ